ਮੇਰੇ ਕੋਲ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਇੱਕ ਕਿਤਾਬ ਹੈ ਜਿਸ ਵਿੱਚ ਉਸ ਦੀ ਜੀਵਨੀ ਬਾਰੇ ਦੱਸਿਆ ਗਿਆ ਹੈ ਕਿ ਉਸ ਨੇ ਕੀ ਸੰਘਰਸ਼ ਅਤੇ ਔਕੜਾਂ ਦਾ ਆਪਣੇ ਸਾਹਮਣਾ ਜੀਵਨ ਵਿੱਚ ਕੀਤਾ ਅਤੇ ਉਸਦੇ ਨਾਲ ਮੈਨੂੰ ਵੀ ਮੇਰੀ ਜ਼ਿੰਦਗੀ ਵਿੱਚ ਹੋਰ ਚੀਜ਼ਾਂ ਜਾਂ ਜ਼ਿੰਦਗੀ ਨੂੰ ਕਿਵੇਂ ਚੰਗੇ ਤ ਢੰਗ ਨਾਲ ਜੀਣ ਤੋਂ ਮੈਂ ਪ੍ਰੇਰਿਤ ਹੋਇਆ ਹਾਂ ਉਸ ਤੋਂ ਇਲਾਵਾ ਉਸ ਦੇ ਵਿੱਚ ਇੱਕ ਸੰਘਰਸ਼ ਨੂੰ ਕਿੱਦਾਂ ਕਰਦੇ ਹਨ ਉਹ ਸਭ ਕੁਛ ਦਿੱਤਾ ਗਿਆ ਹੈ ਅਤੇ ਬੁਲੰਦੀਆਂ ਨੂੰ ਛੂਹਣਾ ਕਿੱਦਾਂ ਹੁੰਦਾ ਹੈ ਅਤੇ ਉਸ ਕਿਤਾਬ ਵਿੱਚ ਦਿੱਤਾ ਗਿਆ ਹੈ